ਤਸਵੀਰ ਖਿੱਚਣਾ ਅੱਜ ਦੀ ਨੌਜਵਾਨ ਪੀੜ੍ਹੀ ਲਈ ਇੱਕ ਆਮ ਸ਼ੌਂਕ ਹੈ ਇਸੇ ਤਰ੍ਹਾਂ ਜਦੋਂ ਮੈਂ ਵੀ ਆਪਣਾ ਸੁਰਤ ਸੰਭਾਲੀ ਉਦੋਂ ਮੈਨੂੰ ਵੀ ਤਸਵੀਰ ਖਿੱਚਣ ਦਾ ਬੜਾ ਸ਼ੌਂਕ ਸੀ ਸ਼ੌਂਕ ਹੈ ਮੈਨੂੰ ਜ਼ਿਆਦਾਤਰ ਕੁਦਰਤ ਦੀ ਤਸਵੀਰਾਂ ਖਿੱਚਣੀਆਂ ਬਹੁਤ ਪਸੰਦ ਹਨ ਅਤੇ ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ਆਪਣੀ ਪਹਿਲੀ ਕੁਦਰਤ ਦੀ ਤਸਵੀਰ ਆਪਣੀ ਅੱਠਵੀਂ ਕਲਾਸ ਅੱਠਵੀਂ ਜਮਾਤ ਵਿੱਚ ਖਿੱਚੀ ਸੀ ਅਤੇ ਉਹ ਤਸਵੀਰ ਮੇਰੇ ਕੋਲ ਹਜੇ ਤੱਕ ਸਾਂਭੀ ਹੋਈ ਹੈ ਅਤੇ ਮੈਂ ਇਸੇ ਤਰ੍ਹਾਂ ਉਹ ਤਸਵੀਰ ਲਈ ਮੈਨੂੰ ਕਾਫੀ ਪ੍ਰਸ਼ੰਸਾ ਵੀ ਮਿਲੀ ਅਤੇ ਮੈਂ ਅੱਗੇ ਵੀ ਇਹੀ ਕੋਸ਼ਿਸ਼ ਕਰਦਾ ਹਾਂ ਕਿ ਮੈਂ ਉਹੇ ਜਿਹੀਆਂ ਜਾਂ ਉਸ ਤੋਂ ਵਧੀਆ ਹੋਰ ਵੀ ਵਧੀਆ ਅਤੇ ਖੂਬਸੂਰਤ ਤਸਵੀਰਾਂ ਖਿੱਚਾਂ ਅਤੇ ਆਪਣੇ ਇਹ ਸ਼ੌਂਕ ਨੂੰ ਪੂਰਾ ਕਰ ਸਕਾਂ